ਹੈਲੋ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਜੋਬ ਪਲੇਸਮੈਂਟ ਤੋਂ ਬੋਲ ਰਹੇ ਹੋ ਮੈਂ ਤੁਹਾਡਾ ਬੋਰਡ ਦੇਖਿਆ ਸੀਗਾ ਬਾਹਰ ਲੱਗਿਆ ਹੋਇਆ ਤੁਸੀਂ ਜੋਬਸ ਰਖਵਾਉਂਦੇ ਹੋ ਅਤੇ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਮੈਂ ਪਾਰਟ ਟਾਈਮ ਜੋਬ ਕਰਨੀ ਸੀਗੀ ਤੁਸੀਂ ਦੱਸ ਸਕਦੇ ਹੋ ਵੀ ਕੋਈ ਜੋਬ ਅਪਲਾਈ ਕਰਨ ਲਈ ਕੋਈ ਪਈ ਹੋਵੇ ਵਕ ਹਾਂਜੀ ਹੋਰ ਹਾਂਜੀ ਓਕੇ ਹਾਂਜੀ ਹਾਂਜੀ ਓਕੇ ਅੱਛਾ ਜੀ ਠੀਕ ਹੈ ਜੀ ਐਮਾਜ਼ੋਨ ਫਲਿਪਕਾਰਟ ਬਸ ਯ ਇਹ ਹੀ ਹੈ ਇਹ ਹੀ ਬੋਲਾ ਆਪਨੇ ਅੱਛਾ ਜੀ ਅਤੇ ਸੈਲਰੀ ਵਗੈਰਾ ਓਕੇ ਜੀ ਹਾਂਜੀ ਠੀਕ ਹੈ ਜੀ ਹੋਰ ਸ਼ੁਕਰੀਆ ਫਿਰ ਤੁਹਾਡਾ ਜੀ ਤੁਹਾਡੀ ਫੀਸ

ਹਾਂਜੀ ਠੀਕ ਹੈ ਜੀ ਸ਼ੁਕਰੀਆ ਓਕੇ